ਸਾਡੇ ਪਿੰਡ ਵਿੱਚ ਇੱਕ ਹੀ ਭਜਨ ਮੰਡਲੀ ਹੈ ਜੋ ਕਿ ਔਰਤਾਂ ਨੇ ਖੁਦ ਬਣਾਈ ਹੋਈ ਹੈ ਜਿਸ ਵਿੱਚ ਸਾਡੇ ਪਿੰਡ ਦੀਆਂ ਹੀ ਔਰਤਾਂ ਸ਼ਾਮਿਲ ਹਨ ਉਹ ਉਹਦੇ ਵਿੱਚ ਮੈਕਸੀਮਮ ਢੋਲਕੀ ਚਿਮਟਾ ਔਰ ਛੈਣੇ ਇਹ ਸੰਗੀਤ ਯੰਤਰ ਵਰਤਦੇ ਹਨ ਜੋ ਕਿ ਬਸ ਧਾਰਮਿਕ ਗੀਤ ਗਾਉਣ ਲਈ ਹੀ ਵਰਤੇ ਜਾਂਦੇ ਹਨ ਧੰਨਵਾਦ